ਖੇਤੀਬਾੜੀ ਬਾਰੇ ਕਹਾਂ ਤਾਂ ਮੈਂ ਖੇਤੀਬਾੜੀ ਕਰਦੀ ਹਾਂ ਮੈਨੂੰ ਖੇਤੀਬਾੜੀ ਕਰਨਾ ਬਹੁਤ ਪਸੰਦ ਹੈ ਮੈਂ ਘਰ ਵਿੱਚ ਅਤੇ ਬਾਹਰ ਦੋਵੇਂ ਜਗ੍ਹਾ 'ਤੇ ਖੇਤੀਬਾੜੀ ਕਰਦੀ ਹਾਂ ਸਬਜ਼ੀਆਂ ਦਾਲ ਚਾਵਲ ਅਨਾਜ ਫੁੱਲ ਬੂਟੇ ਇਹਨਾਂ ਸਾਰਿਆਂ ਦੀ ਖੇਤੀ ਮੈਂ ਕਰਦੀ ਹਾਂ ਆਉਣ ਵਾਲੀ ਪੀੜ੍ਹੀ ਬਾਰੇ ਕਹਾਂ ਤਾਂ ਇਹਨਾਂ ਨੂੰ ਖੇਤੀਬਾੜੀ ਬਾਰੇ ਕੁਝ ਵੀ ਨਹੀਂ ਪਤਾ ਪੜ੍ਹਾਈ ਵਿੱਚ ਖੇਤੀਬਾੜੀ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਇਹ ਮਿੱਟੀ ਦੇ ਨਾਮ ਤੋਂ ਕਾਫ਼ੀ ਦੂਰ ਨੇ ਖੇਤੀਬਾੜੀ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਸਿਖਾਉਣੀ ਚਾਹੀਦੀ ਹੈ ਤਾਂ ਕਿ ਇਹ ਆਉਣ ਵਾਲੀ ਪੀੜ੍ਹੀ ਨੂੰ ਸੁਝਾਅ ਦਿੰਦੀ ਹਾਂ ਕਿ ਤੁਸੀਂ ਖੇਤੀਬਾੜੀ ਕਰਦੇ ਹੀ ਰਹੋ ਅਤੇ ਕਰਨੀ ਵੀ ਚਾਹੀਦੀ ਹੈ ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡਾ ਖਾਣਾ ਪੀਣਾ ਸਭ ਖੇਤੀਬਾੜੀ ਚੋਂ ਹੀ ਆਉਂਦਾ ਹੈ ਖੇਤੀ ਕਰਾਂਗੇ ਤਾਂ ਹੀ ਆਪਾਂ ਕੁਝ ਖਾਵਾਂਗੇ ਪਰ ਆਉਣ ਵਾਲੀ ਪੀੜ੍ਹੀ ਨੂੰ ਇਹ ਕੌਣ ਦੱਸੇ ਖੇਤੀਬਾੜੀ ਬਹੁਤ ਹੀ ਮਹੱਤਵ ਹੈ